ਸਿੱਖਿਆ ਪ੍ਰਣਾਲੀ ਸਮੱਸਿਆਵਾਂ ਦੇ ਹੱਲ ਦੀ ਚਰਚਾ ਪੰਜਾਬ ਵਿੱਚ ਵਿਸ਼ੇਸ਼ ਤੌਰ 'ਤੇ ਗੰਭੀਰ ਮਾਮਲਾ ਬਣੀ ਹੈ ਇਹ ਸਮੱਸਿਆਵਾਂ ਟੀਚਰਾਂ ਅਤੇ ਵਿਦਿਆਰਥੀਆਂ ਦੀ ਲੋੜਾਂ ਅਤੇ ਤਰੱਕੀ ਵਿੱਚ ਰੁਕਾਵਟ ਪੈਦਾ ਕਰਦੀ ਹੈ ਇਸ ਨੂੰ ਹੱਲ ਕਰਨ ਵਿੱਚ ਕੁਝ ਮ ਪ੍ਰਮੁੱਖ ਉਦਾਹਰਣਾਂ ਹਨ ਜਿਵੇਂ ਕਿ ਵਿਦਿਆਰਥੀਆਂ ਦੀ ਸਾਂਝੀ ਲੋੜਾਂ ਦੇ ਸੰਬੰਧ ਵਿੱਚ ਵੱਡੀ ਉਮੀਦ ਹੁੰਦੀ ਹੈ ਉਹਨਾਂ ਦੀਆਂ ਲੋੜਾਂ ਨੂੰ ਪੂਰਤੀ ਕਰਨ ਲਈ ਸਿਰਫ਼ ਸਿੱਖਿਆ ਪ੍ਰਣਾਲੀ ਵਿੱਚ ਅਧਿਆਪਣ ਨਹੀਂ ਬਲਕਿ ਮੁੱਖ ਸਮਾਜ ਸਰਕਾਰ ਦੀ ਵੀ ਲੋੜ ਹੁੰਦੀ ਹੈ ਇਸ ਸਿੱਖਿਆ ਦੇ ਹੱਲ ਲਈ ਵਿਦਿਆਰਥੀਆਂ ਦੀ ਸਮਝ ਨੂੰ ਵਧਾਉਣ ਵਾਲੀ ਸਕੂਲਿੰਗ ਸਿਸਟਮ ਨੂੰ ਸੁਧਾਰ ਕਰਨ ਦੀ ਜ਼ਰੂਰਤ ਹੈ ਜੋ ਉਹਨਾਂ ਨੂੰ ਪਰੇਕੀਟਲ ਅਤੇ ਸਮਰੱਥਾ ਵੀ ਵਿੱਚ ਵੀ ਮਦਦ ਕਰੇ ਨਾਲ ਹੀ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਸਮਝ ਵਧਾਉਣ ਲਈ ਅਧਿਕ ਉਤਪੰਨਿਕ ਸਕੂਲਿੰਗ ਸਿਸਟਮ ਅਤੇ ਵਿਦਿਆਰਥੀ ਸਹਾਇਕ ਕਾਰਨ ਕਾਰਕ ਪ੍ਰਧਾਨ ਕਰਨ ਦੀ ਜ਼ਰੂਰਤ ਹੈ ਰੈਗੂਲਰ ਟੀਚਰ ਪੈਰੇਂਟ ਟੀਚਰ ਮੀਟਿੰਗ ਕਰਵਾਉਣ ਦੀ ਜ਼ਰੂਰਤ ਹੈ ਤਾਂ ਜੋ ਘਰ ਦੇ ਵੀ ਵਿਦਿਆਰਥੀਆਂ ਦੀ ਸਿੱਖਿਆ ਸਬੰਧੀ ਵਾਧਾ ਕਰਨ ਵਿੱਚ ਯੋਗਦਾਨ ਹੋਵਣ ਸਾਨੂੰ ਸਕੂਲ ਵਿੱਚ ਕਲਚਰਲ ਐਕਟੀਵਿਟੀਜ਼ ਅਤੇ ਸਕੂਲ ਦਾ ਇਨਫਰਾਸਟਰਕਚਰ ਜਿਹੜਾ ਵਧਾਉਣ ਦੀ ਜ਼ਰੂਰਤ ਹੈ ਤਾਂ ਜੋ ਸ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕੀਤੇ ਜਾ ਸਕਣ